ਖੇਤੀਬਾੜੀ ਖਾਤਰ ਪਾਣੀ ਦੇ ਜਿਹੜੇ ਕੁਦਰਤੀ ਸ੍ਰੋਤ ਹੈ ਇਹ ਤਾਂ ਅੱਜ ਕੱਲ੍ਹ ਬਹੁਤ ਘੱਟ ਗਏ ਪਹਿਲਾਂ ਕੁਦਰਤੀ ਸ੍ਰੋਤ ਨਾਲ ਲੋਕ ਖੇਤੀ ਕਰਦੇ ਹੁੰਦੇ ਤੇ ਅਸੀਂ ਵੀ ਕਰਦੇ ਹੁੰਦੇ ਤੇ ਜਿਵੇਂ ਮੱਕੀ ਪਾ ਮੀਂਹ ਪੈ ਗਿਆ ਮੱਕੀ ਬੀਜ ਦਿਉ ਅਤੇ ਚਰ੍ਹੀਂ ਬੀਜ ਦਿਉ ਤੋਂ ਬਾਅਦ ਮੀਂਹ ਲਗਾਤਾਰ ਹੁੰਦੇ ਰਹਿੰਦੇ ਅੱਜ ਕੱਲ੍ਹ ਉਹਨਾਂ ਦਾ ਜਿਹੜਾ ਹੈਗਾ ਮੀਂਹ ਦਾ ਤੋਡਾ ਇਹ ਘੱਟ ਗਿਆ ਇਹਦੇ ਕਰਕੇ ਜ਼ਮੀਨ ਹੈ ਜਿਹੜੀ ਇਹ ਮੋਟਰਾਂ ਲੱਗੀਆਂ ਹੋਈਆਂ ਬਿਜਲੀ ਦੀਆਂ ਉਹਨਾਂ ਦੇ ਨਾਲ ਹੀ ਸਿੰਜਣਾ ਪੈਂਦਾ ਜਿਵੇਂ ਗੰਨਾ ਆਪਾਂ ਬੀਜੀਏ ਗੰਨੇ ਨੂੰ ਪਾਣੀ ਥੋੜ੍ਹੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਅਤੇ ਇਸ ਕਰਕੇ ਕੁਦਰਤੀ ਸ੍ਰੋਤ ਅੱਜ ਕੱਲ੍ਹ ਦਿਨ ਪਰ ਦਿਨ ਘਟਦੇ ਜਾ ਰਹੇ ਨੇ ਅਤੇ ਆਮ ਕਰਕੇ ਖੇਤੀਬਾੜੀ ਹੈ ਜਿਹੜੀ ਇਹ ਬਿਜਲੀ ਦੀਆਂ ਮੋਟਰਾਂ ਪਰੇ ਨਿਰਭਰ ਹੈ